ਅੱਜ ਕੱਲ੍ਹ ਪੜ੍ਹਾਈ ਦੇ ਨਾਲ ਨਾਲ ਡਰਾਇੰਗ ਵੀ ਸਿਖਾਈ ਜਾਂਦੀ ਹੈ ਅੱਗੇ ਬੱਚਿਆਂ ਨੂੰ ਇਹ ਚੀਜ਼ਾਂ ਨਹੀਂ ਸਿਖਾਈਆਂ ਪੁਰਾਣੇ ਜ਼ਮਾਨੇ ਵਿੱਚ ਬੱਚੇ ਪੜ੍ਹਾਈ ਦਾ ਬੋਝ ਘੱਟ ਹੁੰਦਾ ਸੀ ਪਰ ਅੱਜ ਕੱਲ੍ਹ ਪੜ੍ਹਾਈ ਦਾ ਬੋਝ ਜ਼ਿਆਦਾ ਅਤੇ ਲੋਕ ਆਪਣੇ ਬੱਚਿਆਂ ਨੂੰ ਡਰਾਇੰਗ ਦੀ ਨੌਲੇਜ ਜ਼ਿਆਦਾ ਦਿੰਦੇ ਹਨ ਕਿ ਉਹਨਾਂ ਦਾ ਮਨ ਫਰੈਸ਼ ਰਹੇ ਅੱਜ ਕੱਲ੍ਹ ਡਰਾਇੰਗ ਇੰਨੀ ਅੱਗੇ ਵਧਾ ਰਹੇ ਹਨ ਅੱਗੇ ਇਹ ਜਮਾਂ ਜ਼ਮਾਨੇ ਵਿੱਚ ਡਰਾਇੰਗ ਨੂੰ ਨਹੀਂ ਕਿਹਾ ਜਾਂਦਾ ਸੀ ਪਰ ਅੱਜ ਕੱਲ੍ਹ ਡਰੈਂਗ ਦੇ ਟੀਚਰ ਵੀ ਰੱਖੇ ਜਾਂਦੇ ਆ ਅਤੇ ਲੋਕਾਂ ਨੂੰ ਕੋਲਜਾਂ ਵਿੱਚ ਟੀਚਰ ਵੀ ਲੱਗੇ ਹੁੰਦੇ ਹਨ ਦੇ ਸਿਖਾਉਂਦੇ ਆ ਅਤੇ ਉਹਨਾਂ ਨੂੰ ਸਿਖਾਉਂਦੇ ਆ ਟੀਚ ਡਰਾਇੰਗ ਅਤੇ ਆਨਲਾਈਨ ਵੀ ਸਿਖਾਈ ਜਾਂਦੀ ਹੈ ਡਰੈਂਗ ਡਰਾਇੰਗ ਇੱਕ ਇਹੋ ਜਿਹੀ ਕਲਾ ਕਿ ਸਾਨੂੰ ਇਹਨਾਂ ਬਾਰੇ ਬਹੁਤ ਵਧੀਆ ਅੱਗੇ ਜਾ ਕੇ ਵੀ ਡਰਾਇੰਗ ਦੀ ਅੱਗੇ ਨਾਲੇਜ ਜ਼ਿਆਦਾ ਵਧੀ ਅਤੇ ਬੱਚਿਆਂ ਲਈ ਵੀ ਜ਼ਿਆਦਾ ਅੱਗੇ ਹੋਰ ਡਰਾਇੰਗ ਦੀ ਮਹੱਤਤਾ ਦਿੱਤੀ ਜਾਂਦੀ ਹੈ ਟੀਚਰ ਬਣ ਜਾਂਦੇ ਆ ਇਹਨਾਂ ਦਾ ਉਹ ਦਿੰਦੇ ਆ ਕਈਆਂ ਸਕੂਲਾਂ ਵਿੱਚ ਟੀਚਰ ਬਣਾਏ ਜਾਂਦੇ ਆ ਡਰਾਇੰਗ ਦੇ